ਸਰੀਰ ਨੂੰ ਤੰਦਰੁਸਤ ਰੱਖਣ ਲਈ ਮੈਂ ਆਪਣੀਆਂ ਸਹੇਲੀਆਂ ਨਾਲ ਸਵੇਰੇ ਮੰਡੀ ਵਿੱਚ ਜਾ ਕੇ ਦੌੜ ਲਗਾਉਣਾ ਬਹੁਤ ਚੰਗਾ ਸਮਝਦੀ ਹਾਂ ਮੈਨੂੰ ਉੱਥੇ ਜਾ ਕੇ ਬਹੁਤ ਵਧੀਆ ਮਹਿਸੂਸ ਹੁੰਦਾ ਹੈ ਇੱਕ ਤਾਂ ਉੱਥੇ ਬਹੁਤ ਜ਼ਿਆਦਾ ਪੇੜ ਪੌਦੇ ਹਨ ਜਿਸ ਤੋਂ ਠੰਡੀ ਠੰਡੀ ਹਵਾ ਸਵੇਰੇ ਸਰੀਰ ਨੂੰ ਮਿਲਦੀ ਹੈ ਅਤੇ ਉੱਥੇ ਆਰਾਮ ਵੀ ਬਹੁਤ ਜ਼ਿਆਦਾ ਮਹਿਸੂਸ ਹੁੰਦਾ ਹੈ ਤਾਂ ਉੱਥੇ ਹੋਰ ਵੀ ਬਹੁਤ ਸਾਰੇ ਲੋਕ ਆਉਂਦੇ ਹਨ ਜਿਹੜੇ ਸਵੇਰੇ ਦੌੜਨ ਲਈ ਛੋਟੇ ਬੱਚੇ ਦੌੜਦੇ ਹਨ ਵੱਡੇ ਦੌੜਦੇ ਹਨ ਅਤੇ ਬਜ਼ੁਰਗ ਵੀ ਦੌੜਦੇ ਹਨ ਜਿਸ ਦੀ ਕਪੈਸਿਟੀ ਹੈ ਉਹ ਕੋਈ ਦੋ ਚੱਕਰ ਲਗਾਉਂਦਾ ਹੈ ਕੋਈ ਤਿੰਨ ਚੱਕਰ ਲਗਾਉਂਦਾ ਹੈ ਜਿਸ ਦੀ ਜਿੰਨੀ ਦੌੜਨ ਦੀ ਸਮਰੱਥਾ ਹੁੰਦੀ ਹੈ ਸਭ ਦੌੜਦੇ ਹਨ ਅਤੇ ਮੈਂ ਵੀ ਉਹਨਾਂ ਨਾਲ ਕਈ ਵਾਰ ਦੌੜ ਲਗਾਉਣਾ ਸ਼ੁਰੂ ਕਰ ਦਿੰਦੀ ਹਾਂ ਮੈਨੂੰ ਮੰਡੀ ਵਿੱਚ ਜਾ ਕੇ ਦੌੜ ਲਗਾਉਣਾ ਬਹੁਤ ਵਧੀਆ ਲੱਗਦਾ ਹੈ ਜੋ ਮੇਰੇ ਨਾਲ ਮੇਰੀਆਂ ਸਹੇਲੀਆਂ ਜਾਂਦੀਆਂ ਹਨ ਉਹਨਾਂ ਵਿੱਚੋਂ ਕਈ ਆਪਣੇ ਸਰੀਰ ਕਰਕੇ ਬਹੁਤ ਘੱਟ ਦੌੜਦੀਆਂ ਹਨ ਕਈ ਸਿਰਫ ਸੈਰ ਕਰਨਾ ਹੀ ਪਸੰਦ ਕਰਦੀਆਂ ਹਨ ਅਤੇ ਉਹਨਾਂ ਵਿੱਚੋਂ ਕਈ ਯੋਗਾ ਵੀ ਬੈਠ ਕੇ ਕਰ ਲੈਂਦੀਆਂ ਹਨ ਅਸੀਂ ਉੱਥੇ ਪੂਰਾ ਇੱਕ ਘੰਟਾ ਲਗਾ ਕੇ ਆਉਂਦੇ ਹਾਂ ਵਿੱਚ ਉੱਥੇ ਕੁਛ ਹੋਰ ਵੀ ਬਹੁਤ ਕੁਛ ਸਿੱਖਣ ਨੂੰ ਮਿਲਦਾ ਹੈ ਕੁਝ ਲੋਕ ਬਰਸ਼ਿਸ ਵਰਜਿਸ਼ ਕਰਦੇ ਹਨ ਕੁਛ ਯੋਗਾ ਕਰਦੇ ਹਨ ਕੁਛ ਦੌੜਦੇ ਹਨ ਕੁਛ ਬੱਚਿਆਂ ਨੂੰ ਉੱਥੇ ਖੇਡਣ ਦੀ ਸਿਖਲਾਈ ਦਿੰਦੇ ਹਨ ਉਹ ਸਾਰਾ ਦੇਖਣਾ ਬਹੁਤ ਵਧੀਆ ਲੱਗਦਾ ਹੈ ਚਾਰ ਚੁਫੇਰੇ ਇੰਨਾ ਵਧੀਆ ਮੌਸਮ ਹੁੰਦਾ ਹੈ ਪੰਛੀ ਚਹਿ ਚਹਾਉਂਦੇ ਹਨ ਠੰਡੀ ਠੰਡੀ ਹਵਾ ਚੱਲ ਰਹੀ ਹੁੰਦੀ ਹੈ ਜਿਹੜਾ ਦੇਖ ਕੇ ਬਹੁਤ ਵਧੀਆ ਲੱਗਦਾ ਹੈ ਅਤੇ ਜਦੋਂ ਕਦੀ ਉੱਥੇ ਪਾਣੀ ਜਾਂ ਮੀਂਹ ਜਾਂ ਬਾਰਿਸ਼ ਹੋ ਜਾਵੇ ਦੌੜਨ ਨਾਲ ਦੌੜਨ ਨਾਲ ਜਦੋਂ ਵੀ ਅਸੀਂ ਦੌੜਦੇ ਹਾਂ ਤਾਂ ਮਨ ਸਾਡਾ ਬਹੁਤ ਜ਼ਿਅਦਾ ਸ਼ਾਂਤੀ ਪ੍ਰਦਾਨ ਕਰਦਾ ਹੈ ਅਤੇ ਤਣਾਅ ਦੇ ਲੱਛਣਾਂ ਨੂੰ ਘਟਾਉਂਦਾ ਹੈ ਧਿਆ ਦੌੜਨ ਨਾਲ ਧਿਆਨ ਵੀ ਸਾਡਾ ਕੇਂਦਰਿਤ ਕਰਨ ਦੀ ਸਮਰੱਥਾ ਵੱਧਦੀ ਹੈ ਜਿਸ ਨਾਲ ਮਨ ਸ਼ਾਂਤ ਅਤੇ ਫੋਕਸ ਬਣਾਉਣ ਵਿਚ ਮਦਦ ਮਿਲਦੀ ਹੈ ਨਿਯਮਤ ਦੌੜਨ ਨਾਲ ਸਰੀਰ ਦੀ ਊਰਜਾ ਵੱਧਦੀ ਹੈ ਜਿਸ ਨਾਲ ਦਿਨ ਦੀਆਂ ਕਿਰਿਆਵਾਂ ਵਿੱਚ ਬਹੁਤ ਜ਼ਿਆਦਾ